ਹਾਂਜੀ ਸਾਡੇ ਨੇੜੇ ਹੀ ਆਮ ਖਾਸ ਬਾਗ ਆ ਜਿੱਥੇ ਕਿ ਕੁਛ ਫੰਕਸ਼ਨ ਹੁੰਦੇ ਨੇ ਪੰਜਾਬ ਦੇ ਕਲਚਰ ਦੇ ਰਿਲੇਟਡ ਕਾਫੀ ਫੰਕਸ਼ਨ ਹੁੰਦੇ ਨੇ ਉਹਨਾਂ ਵਿੱਚੋਂ ਫੇਮਸ ਆ ਜਿਵੇਂ ਕਿ ਤੀਆਂ ਤੀਆਂ ਦੇ ਵਿੱਚ ਕਾਫੀ ਸ਼ ਮਤਲਬ ਕਿ ਲੋਕ ਆਪਣਾ ਦਿਖਾਉਂਦੇ ਨੇ ਵੀ ਜਿਵੇਂ ਕਿ ਆਪਾਂ ਪੇਂਟਿੰਗ ਨੂੰ ਲਾ ਕੇ ਹੀ ਚੱਲਦੇ ਆ ਪੇਂਟਿੰਗ ਦੇ ਨਾਲ ਜੁੜੀਆਂ ਫੋਟੋਜ਼ ਲਿਆਉਂਦੇ ਨੇ ਸ਼ੋਅ ਕਰ ਆਪਣਾ ਨਮੂਨੇ ਦਿਖਾਉਂਦੇ ਨੇ ਅਤੇ ਸੈਂਪਲ ਦਿਖਾਉਂਦੇ ਨੇ ਵੀ ਆਹ ਚੀਜ਼ਾਂ ਅਸੀਂ ਕੀਤੀਆਂ ਹੋਈਆਂ ਆ ਉੱਥੇ ਕਾਫੀ ਲੋਕ ਆਉਂਦੇ ਬਹੁਤ ਦੁਨੀਆਂ ਦੇ ਲੋਕ ਆਉਂਦੇ ਨੇ ਘੁੰਮਦੇ ਫਿਰਦੇ ਨੇ ਤਾਂ ਉਹ ਚੀਜ਼ਾਂ ਦੇਖਦੇ ਨੇ ਅਤੇ ਉੱਥੇ ਆਪਣੀਆਂ ਉਹ ਫੋਟੋਜ਼ ਵੀ ਕਲਿੱਕ ਕਰਦੇ ਨੇ ਸ਼ੂਟਿੰਗ ਵੀ ਉੱਥੇ ਫਿਲਮਾਂ ਦੀ ਕਾਫੀ ਸ਼ੂਟਿੰਗ ਵੀ ਹੁੰਦੀ ਹੈ ਕਾਫੀ ਫਿਲਮਾਂ ਦੇ ਵਿੱਚ ਤੁਸੀਂ ਆਮ ਖਾਸ ਬਾਗ ਵਿੱਚ ਦੇਖਿਆ ਹੋਊ ਸ਼ੂਟਿੰਗਸ ਹੁੰਦੀ ਹੈ ਫਿਲਮਾਂ ਦੀ ਸ਼ੂਟਿੰਗ ਹੁੰਦੀ ਆ ਤਾਂ ਉਹ ਇਹਨਾਂ ਸ਼ਿਲਪਕਾਰੀਆਂ ਦੀ ਸੀਨ ਲੈ ਕੇ ਆਪਣਾ ਕਰਦੇ ਨੇ ਇਹ ਕਲਚਰ ਨੂੰ ਵੀ ਆਪਸ ਵਿੱਚ ਜੋੜਦੇ ਨੇ ਉੱਥੇ ਜਦ ਪੰਜਾਬੀ ਰਿਲੇਟਡ ਕੋਈ ਪੇਂਟਿੰਗਸ ਪਈਆਂ ਹੋਣ ਜਾਂ ਕੋਈ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਹੋਰ ਵੀ ਚੀਜ਼ਾਂ ਲੋਕ ਉਹਨਾਂ ਨੂੰ ਫੋਟੋ ਖਿੱਚ ਕੇ ਲੈ ਕੇ ਜਾਂਦੇ ਹਨ ਅਤੇ ਯਾਦਗਾਰੀ ਵੀ ਰੱਖਦੇ ਹਨ ਅਤੇ ਦੂਸਰਾ ਉਹਦੇ ਨਾਲ ਇਹ ਵੀ ਹੋ ਜਾਂਦਾ ਵੀ ਲੋਕਾਂ ਨੂੰ ਸੱਭਿਆਚਾਰ ਦੇ ਨਾਲ ਜੁੜੇ ਵੀ ਰਹਿੰਦੇ ਨੇ ਸੱਭਿਆਚਾਰ ਜੁੜਨ ਦੇ ਨਾਲ ਨਾਲ ਜਿਹੜੀਆਂ ਅੱਜ ਕੱਲ੍ਹ ਨਵੀਆਂ ਪੀੜ੍ਹੀਆਂ ਆ ਰਹੀਆਂ ਜਿਹਨਾਂ ਨੂੰ ਇਹਨਾਂ ਚੀਜ਼ਾਂ ਦੇ ਪੰਜਾਬ ਦੇ ਇਤਿਹਾਸ ਪੰਜਾਬ ਦੀਆਂ ਚੀਜ਼ਾਂ ਬਾਰੇ ਨਹੀਂ ਪਤਾ ਉਹ ਇਹਨਾਂ ਚੀਜ਼ਾਂ ਨਾਲ ਜਾਣੂ ਹੋ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਨੌਲੇਜ ਦਿੰਦੇ ਨੇ ਮਤਲਬ ਕਿ ਲੋੜ ਹੈ ਵੀ ਪੰਜਾਬੀ ਕਲਚਾ ਕਲਚਰ ਨੂੰ ਕਾਫੀ ਉੱਪਰ ਲੈ ਕੇ ਜਾਣ ਲਈ ਇਸ ਕਰਕੇ ਮਤਲਬ ਕਿ ਜਿੰਨਾਂ ਵੀ ਹੋ ਸਕਦਾ ਆ ਜੋ ਵੀ ਪੇਂਟਿੰਗ ਹੁੰਦੀ ਜਾਂ ਕੁਛ ਵੀ ਆ ਜੋ ਪੈਂਟਰ ਪੇਂਟ ਬਣਾ ਰਹੇ ਨੇ ਜਾਂ ਕੁਛ ਹੋਰ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਚੀਜ਼ਾਂ ਨੇ ਉਹਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ 'ਤੇ ਮੇਲਿਆਂ ਦੇ ਵਿੱਚ ਦਿਖਾਉਣਾ ਚਾਹੀਦਾ ਜਦ ਜਦ ਕਿਉਂਕਿ ਇਹਨਾਂ ਨਾਲ ਬੱਚੇ ਬਹੁਤ ਨੌਲੇਜ ਲੈਂਦੇ ਨੇ ਅਤੇ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਵੀ ਮਿਲਦਾ ਅਤੇ ਦੇਖਣ ਨੂੰ ਵੀ ਮਿਲਦਾ ਹੈ